ਹੈਲੋ ਹਾਂਜੀ ਬੋਲਦੀ ਹੈਲੋ ਹਾਂਜੀ ਮੈਂ ਪਲਕ ਮੈਂ ਇੱਕ ਬਲੋਗਰ ਹਾਂ ਅਤੇ ਮੈਂ ਤੁਹਾਡੇ ਤੋਂ ਪੁੱਛਣਾ ਸੀਗਾ ਕਿ ਅੱਜ ਕੱਲ੍ਹ ਹੁਸ਼ਿਆਰਪੁਰ ਦਾ ਯੂਥ ਬਾਹਰ ਕਿਉਂ ਜਾ ਰਿਹਾ ਹਾਂਜੀ

ਹਾਂਜੀ

ਹਾਂਜੀ ਹਾਂਜੀ ਤੇ ਦੇਖਾ ਦੇਖੀ ਵਿੱਚ ਬਹੁਤ ਜਾ ਰਹੇ ਆ ਮਤਲਬ ਜਿੱਦਾਂ ਉਹ ਗਿਆ ਤਾਂ ਮੈਂ ਵੀ ਜਾਊਂਗਾ ਜਾਂ ਜਾਊਂਗੀ ਹੋਰ ਤੁਹਾਡੇ ਵੱਲੋਂ ਵੀ ਕੋਈ ਗਿਆ ਅੱਛਾ ਕਿੱਦਾਂ ਵਧੀਆ ਰਹਿ ਰਹੇ ਉੱਥੇ ਅੱਛਾ ਅੱਛਾ

ਅੱਛਾ ਅੱਛਾ ਹਾਂਜੀ ਹਾਂਜੀ

ਕਈ ਸਟਡੀ ਬੇਸ 'ਤੇ ਜਾਂਦੇ ਕਈ ਵਰਕ ਬੇਸ 'ਤੇ ਜਾਂਦੇ ਹਾਂਜੀ ਫੈਮਲੀ ਤੋਂ ਦੂਰ ਤੁਸੀਂ ਕਿਥੋਂ ਬੋਲਦੇ ਮੈਂ ਤਾਂ ਲੋਕਲ ਹੀ ਹੁਸ਼ਿਆਰਪੁਰ ਤੋਂ ਤੁਸੀਂ ਵੀ ਜਾਣਾ ਬਾਹਰ ਅੱਛਾ ਕਦੋਂ ਨੂੰ ਜਾਊਂਗੇ ਫਿਰ ਅ ਕਰ ਲਈ ਆਈਲੈਸ ਵਗੈਰਾ ਕਿ ਵਰਕ ਬੇਸ 'ਤੇ ਜਾਣਾ ਕਿੱਦਾਂ ਜਾਣਾ ਅੱਛਾ ਸਿੱਖਿਆ ਨਹੀਂ ਹਜੇ ਸਿੱਖਣਾ ਕਿਹਨਾਂ ਦੇ ਕਰਦੇ ਲੈਕਮੀ ਵਾਲਿਆਂ ਦੇ ਅੱਛਾ ਕਿੰਨੇ ਨੇ ਕੁ ਟਾਈਮ ਦਾ ਰਹਿ ਗਿਆ ਹੋਰ ਕਿੱਥੇ ਕੈਨੇਡਾ ਜਾਣਾ ਇੰਗਲੈਂਡ

ਅੱਛਾ ਅੱਛਾ ਤੁਹਾਡੇ ਕੋਈ ਰਲੇਟਿਵ ਵਗੈਰਾ ਰਹਿੰਦੇ ਆ ਉੱਥੇ ਅੱਛਾ ਸਾਰੇ ਹੀ ਹੁਣ ਤੁਸੀਂ ਜਾਣਾ ਮਤਲਬ

ਚਲੋ ਵਧੀਆ ਜਾਓ ਤੁਸੀਂ ਵੀ ਮੈਂ ਵੀ ਬੀਕੌਮ ਕਰਦੀ ਹਾਂਜੀ ਇਹ ਕੀ ਕਹਿੰਦੇ ਆਹ ਡੀ ਏ ਵੀ ਕਾਲਜ ਪਤਾ ਹੋਣਾ ਤੁਹਾਨੂੰ ਹਾਂਜੀ ਉੱਥੇ ਹਾਂਜੀ ਓਕੇ ਜੀ ਬਾਏ